ਹਾਂਜੀ ਤੁਸੀਂ ਵੈਡਿੰਗ ਪਲੈਨਰ ਤੋਂ ਬੋਲ ਰਹੇ ਹੋ ਐਕਚੁਅਲੀ ਨਾ ਮੈਂ ਆਪਣੇ ਬ੍ਰਦਰ ਦੀ ਵੈਡਿੰਗ ਵਾਸਤੇ ਪਲੈਨਰ ਲੱਭ ਰਹੀ ਸੀਗੀ ਤਾਂ ਮੈਨੂੰ ਅਰੇਂਜਮੈਂਟਸ ਦੱਸ ਸਕਦੇ ਹੋ ਕਿ ਕੀ ਕੀ ਪ੍ਰੋਵਾਈਡ ਕਰਵਾ ਸਕਦੇ ਹੋ ਤੁਸੀਂ ਸਾਨੂੰ ਕੀ ਦੇ ਸਕਦੇ ਹੋ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਅਤੇ ਜਿਹੜੀ ਡੈਕੋਰੇਸ਼ਨ ਕਰੋਂਗੇ ਉਹ ਤੁਹਾਡਾ ਜਿਹੜਾ ਸਾਡਾ ਪੈਕੇਜ ਹੋਏਗਾ ਉਹਦੇ ਵਿਚ ਹੀ ਇਨਕਲੂਡ ਕੀਤੀ ਹੋਏਗੀ ਮਤਲਬ ਕਿ ਉਹਦੇ ਵਿੱਚ ਹੀ ਲਉਂਗੇ ਚਾਰਜ਼ਿਜ ਜੋ ਵੀ ਲਉਂਗੇ ਤੁਸੀਂ ਠੀਕ ਹੈ ਅਤੇ ਜਿਹੜਾ ਖਾਣ ਪੀਣ ਦਾ ਜਿਹੜਾ ਜਿਵੇਂ ਸਟੋਲਜ਼ ਵਗੈਰਾ ਹੋਗੀਆਂ ਉਹ ਸਾਰੀਆਂ ਚੀਜ਼ਾਂ ਅਤੇ ਕਿੰਨੀਆਂ ਸਟੋਲਸ ਲਗਾ ਕੇ ਦਊਂਗੇ ਤੁਸੀਂ ਸਾਨੂੰ ਠੀਕ ਹੈ

ਠੀਕ ਹੈ ਮਤਲਬ ਕਿ ਹਰ ਇੱਕ ਸਟੋਲ ਦਾ ਅਲੱਗ ਪ੍ਰਾਈਜ਼ ਹੈ ਠੀਕ ਹੈ ਅਤੇ ਜਿਹੜੇ ਆਪਾਂ ਡੀ ਜੇ ਵਗੈਰਾ ਕਰਾਂਗੇ ਉਹਦੇ ਲਈ ਜਿਹੜਾ ਸੈਪਰੇਟ ਕੋਰਨਰ ਹੋਏਗਾ ਉਹ ਵਿੱਚੇ ਹੋਏਗਾ ਠੀਕ ਹੈ ਜੀ ਅਤੇ ਜਿਵੇਂ ਅਸੀਂ ਪਲੈਨ ਕਰ ਰਹੇ ਜਿਵੇਂ ਥ੍ਰੀ ਡੇਜ਼ ਦਾ ਕਰਨਾ ਅਸੀਂ ਲੇਡੀਜ਼ ਸੰਗੀਤ ਦਾ ਹੋ ਗਿਆ ਅਤੇ ਨੈਕਸਟ ਮੈਰਿਜ਼ ਦਾ ਹੋ ਗਿਆ ਮੈਰਿਜ ਡੇ ਵਾਲੇ ਦਿਨ ਬਰਾਤ ਦਾ ਅਤੇ ਨੈਕਸਟ ਲਾਸਟ ਅਸੀਂ ਰਿਸੈਪਸ਼ਨ ਦਾ ਥ੍ਰੀ ਡੇਜ਼ ਦਾ ਪੈਕੇਜ ਸਾਨੂੰ ਦੱਸ ਸਕਦੇ ਹੋ ਕਿ ਕਿੰਨਾਂ ਦਊਂਗੇ ਤੁਸੀਂ ਸਾਨੂੰ ਠੀਕ ਹੈ ਅਤੇ ਫਿਰ ਮਤਲਬ ਕਿ ਤੁਸੀਂ ਠੀਕ ਹੈ ਸਰ ਫਿਰ ਮੈਂ ਠੀਕ ਹੈ ਠੀਕ ਹੈ ਅਤੇ ਫਿਰ ਅਸੀਂ ਤੁਹਾਡੇ ਔਫਿਸ ਆ ਕੇ ਨਾ ਤੁਹਾਡੇ ਨਾਲ ਡਰੈਕਟ ਫੇਸ ਟੂ ਫੇਸ ਗੱਲ ਕਰ ਲਾਂਗੇ ਅਸੀਂ ਮਿਲ ਲਾਂਗੇ ਠੀਕ ਹੈ ਓਕੇ ਸਰ ਓਕੇ ਬਾਏ ਥੈਂਕ ਯੂ